ਹੈਲੋ ਹਾਂਜੀ ਦਸ ਹਾਂਜੀ ਹਾਂਜੀ ਹਾਂਜੀ ਏ ਰਸੋਈ ਦਾ ਏਰੀਆ ਕਿੰਨਾ ਹੈ ਔਰ ਕੀ ਕੀ ਬਣਵਾਉਣਾ ਚਾਹੁੰਦੇ ਹੋ ਤੁਸੀਂ ਨਹੀਂ ਉਹਦੇ ਵਿੱਚ ਤੁਸੀਂ ਕੀ ਚਾਹੁੰਦੇ ਹੋ ਕੀ ਖਿੜਕੀਆਂ ਬਨ ਖਿੜਕੀਆਂ ਅਤੇ ਵੀ ਸਰਮਾਇਕਾ ਕਿਸ ਤਰ੍ਹਾਂ ਦਾ ਲਗਵਾਉਣਾ ਚਾਹੁੰਦੇ ਹੋ ਜਿਵੇਂ ਖਿੜਕੀਆਂ ਅਤੇ ਹੈ ਹਾਂਜੀ ਠੀਕ ਹੈ ਨਹੀਂ ਨਹੀਂ ਭਾਈ ਸਾਹਿਬ ਆਪਣਾ ਹੁੰਦਾ ਕੀ ਆਪਾਂ ਤੁਹਾਨੂੰ ਇੱਕ ਮਜ਼ਦੂਰ ਦਿਆਂਗੇ ਔਰ ਤੁਹਾਡੀ ਜਿਵੇਂ ਜਿਵੇਂ ਤੁਹਾਡੀ ਹੋਵੇਗਾ ਬਣਵਾਉਣਾ ਚਾਹੁੰਦੇ ਹੋ ਉਹ ਤੁਹਾਨੂੰ ਉੱਥੇ ਆ ਕੇ ਤੁਹਾਡੇ ਉਵੇਂ ਤੁਹਾਡੀ ਜਿਵੇਂ ਇੱਛਾ ਹੈ ਉਵੇਂ ਬਣਾ ਦੇਗਾ ਔਰ ਕੋਈ ਖਿੜਕੀ ਵਗੈਰਾ ਜੋ ਤੁਸੀਂ ਲਗਵਾਉਣ ਚਾਹੁੰਦੇ ਹੋ ਵਿੱਚ ਗੈਸ ਵਗੈਰਾ ਫਿਕਸ ਕਰਵਾਉਣਾ ਚਾਹੁੰਦੇ ਹੋ ਸਰਮਾਇਕਾ ਲਗਵਾ ਕੇ ਅੱਜ ਕੱਲ੍ਹ ਤਾਂ ਚਿਮਨੀਆਂ ਵਿੱਚ ਫਿਕਸ ਹੋ ਜਾਂਦੀਆਂ ਨੇ ਉਹ ਵੀ ਸਾਰਾ ਉਹ ਕਰ ਦੇਣਗੇ ਬਈ ਹੈ ਸਰ ਤਾਂ ਮੈਨੂੰ ਲੱਗਦਾ ਕੀ ਤੁਹਾਡੀ ਇਹ ਰਸੋਈ ਦੀ ਹਿਸਾਬ ਅਤੇ ਨਾ ਘੱਟੋ ਘੱਟ ਵੀਹ ਹਜ਼ਾਰ ਰੁਪਇਆ ਤੁਹਾਡਾ ਖਰਚਾ ਰਹੇਗਾ

ਨਹੀਂ ਨਹੀਂ ਹਾਂਜੀ ਵੀਹ ਹਜ਼ਾਰ ਤਾਂ ਸਾਡੀ ਲੇਬਰ ਹੋਵੇਗੀ ਅਤੇ ਜਿਹੜਾ ਸਮਾਨ ਤੁਸੀਂ ਪਸੰਦ ਕਰੋਗੇ ਅਤੇ ਖਰਚਾ ਉਸ ਹਿਸਾਬ ਨਾਲ ਕਿਉਂਕਿ ਸਰਮਾਇਕਾ ਭਾਈ ਸਾਹਿਬ ਬਹੁਤ ਤਰ੍ਹਾਂ ਦੀ ਆਉਂਦੀ ਹੈ ਮਹਿੰਗੀ ਵੀ ਹੈ ਅਤੇ ਸਸਤੀ ਵੀ ਆਪਣੇ ਕੋਲੋਂ ਅੱਛਾ ਫਿਰ ਵੀ ਤੁਹਾਨੂੰ ਹਾਂਜੀ ਹਾਂਜੀ ਹਾਂਜੀ ਭਾਈ ਸਾਹਿਬ ਕੋਈ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਤੁਸੀਂ ਆਓ ਇੱਕ ਵਾਰੀ ਸਾਡੀ ਦੁਕਾਨ ਅਤੇ ਪਰ ਜਿਹੜਾ ਤੁਸੀਂ ਜਿਹੜੀ ਚੀਜ਼ ਲਗਵਾਉਣੇ ਚਾਹੁੰਦੇ ਹੋ ਸਰਮਾਇਕਾ ਦਾ ਰੰਗ ਕਿਹੜਾ ਲਗਵਾਉਣਾ ਚਾਹੁੰਦੇ ਹੋ ਅਤੇ ਸਰਮਾਇਕਾ ਬਈ ਵਧੀਆ ਵਾਲੀਆਂ ਵੀ ਆਪਣੇ ਕੋਲ ਬਹੁਤ ਸਾਰੀਆਂ ਨੇ ਬਇਆ ਭਾਈ ਸਾਹਿਬ ਅਤੇ ਤੁਸੀਂ ਕਿਹੜੀ ਸਰਮਾਇਕਾ ਪਸੰਦ ਕਰਦੇ ਹੋ ਉਸ ਹਿਸਾਬ 'ਤੇ ਤੁਹਾਨੂੰ ਅਸੀਂ ਰੇਟ ਦੱਸ ਦਿਆਂਗੇ ਅਤੇ ਤੁਸੀਂ ਉਹ ਉਹ ਭਾਈ ਸਾਹਿਬ ਅਸੀਂ ਤੁਹਾਨੂੰ ਤੁਸੀਂ ਆਓਗੇ ਪਹਿਲਾਂ ਸਰਮਾਇਕਾ ਪਸੰਦ ਕਰੋ ਫੇਰ ਤੁਹਾਨੂੰ ਅਸੀਂ ਆਪਣਾ ਮਜ਼ਦੂਰ ਦੇਵਾਂਗੇ ਅਤੇ ਸਾਡਾ ਮਜ਼ਦੂਰ ਸਾਨੂੰ ਆ ਕੇ ਸਾਰਾ ਏਰੀਆ 'ਤੇ ਜਗ੍ਹਾ ਦੱਸੇਗਾ ਕਿੰਨੀ ਕਿੰਨੀ ਜਗ੍ਹਾ 'ਤੇ ਕਿੰਨਾ ਸਰਮਾਇਕਾ ਆਪਣਾ ਲੱਗ ਰਿਹਾ ਅਤੇ ਉਸ ਹਿਸਾਬ ਦੇ ਅਸੀਂ ਤੁਹਾਨੂੰ ਸਾਰਾ ਰੇਟ ਦੱਸਾਂਗੇ ਜਿਸ ਹਿਸਾਬ 'ਤੇ ਤੁਸੀਂ ਰਸੋਈ ਦਾ ਏਰੀਆ ਦੱਸਦੇ ਪਏ ਹੋ ਉਸ ਹਿਸਾਬ 'ਤੇ ਤੁਹਾਡਾ ਸਮ ਮਨ ਮੰਨ ਕੇ ਚੱਲੋ ਕਿ ਪੰਦਰਾਂ ਵੀਹ ਹਜ਼ਾਰ ਦਾ ਜਿਹੜਾ ਸਮਾਨ ਵੀ ਲੱਗ ਸਕਦਾ

ਤੁਸੀਂ ਆਈਡੀਆ ਦੱਸੋ ਭਾਈ ਸਾਹਿਬ ਕਿੰਨਾ ਲਾਉਣਾ ਚਾਹੁੰਦੇ ਹੋ ਹਾਂ ਜ਼ਰੂਰ ਭਾਈ ਸਾਹਿਬ ਜ਼ਰੂਰ ਅਸੀਂ ਤੁਹਾਡੀ ਉਡੀਕ ਕਰਾਂਗੇ ਠੀਕ ਏ ਠੀਕ ਏ ਭਾਅ ਜੀ ਠੀਕ